ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਸੋਣ ਪਰੀ ਇਲੈਕਟ੍ਰੀਕਲ ਤੋਂ ਬੋਲਦੇ ਜੀ ਮੈਂ ਬਾਈ ਨਾ ਤੁਹਾਡੇ ਕੋਲ ਐਗ ਬੋਇਲਰ ਮੰਗਵਾਇਆ ਸੀਗਾ ਸੋਨੀ ਕੰਪਨੀ ਦਾ ਜਿਹੜਾ ਕਿ ਭਾਅ ਜੀ ਤੁਸੀਂ ਚਾਰ ਦਿਨ ਵਿੱਚ ਕਹਿੰਦੇ ਸੀ ਡਿਲੀਵਰ ਕਰਨਾ ਤਿੰਨ ਦਿਨ ਦੇ ਵਿੱਚ ਵਿੱਚ ਡਿਲੀਵਰ ਹੋ ਗਿਆ ਅਤੇ ਭਾਅ ਜੀ ਜਿਹੜਾ ਡਿਲੀਵਰੀ ਕਰਨ ਆਇਆ ਸੀਗਾ ਉਹ ਬੰਦਾ ਵੀ ਵਧੀਆ ਸੀਗਾ ਜੀ ਅਤੇ ਉਹਦਾ ਨੇਚਰ ਵੀ ਬਹੁਤ ਵਧੀਆ ਸੀਗਾ ਅਤੇ ਐਗ ਬੋਇਲਰ ਦੀ ਪੈਕਿੰਗ ਵੀ ਬਹੁਤ ਵਧੀਆ ਜ਼ਬਰਦਸਤ ਕੀਤੀ ਹੋਈ ਸੀਗੀ ਅਤੇ ਕੁਆਲਟੀ ਵੀ ਵਧੀਆ ਚੱਲਣ ਵਿੱਚ ਵੀ ਵਧੀਆ ਸੀਗਾ ਭਾਅ ਜੀ ਅਤੇ ਭਾਅ ਜੀ ਇਹਦੇ ਨਾਲ ਦਾ ਹੀ ਸੇਮ ਇੱਕ ਮੇਰਾ ਦੋਸਤ ਏ ਆ ਉਹ ਵੀ ਮੰਗਾਉਣ ਨੂੰ ਫਿਰਦਾ ਜੀ ਅਤੇ ਬਿਜਲੀ ਦੀ ਖਪਤ ਵੀ ਬਹੁਤ ਘੱਟ ਇਹਦੇ ਨਾਲ ਜੀ ਅਤੇ ਜੇ ਇੱਦਾਂ ਦਾ ਕੋਈ ਹੋਰ ਪ੍ਰੋਡਕਟ ਹੋਇਆ ਤੁਹਾਡੇ ਕੋਲ ਤਾਂ ਮੈਨੂੰ ਜ਼ਰੂਰ ਦੱਸਿਓ ਭਾਅ ਜੀ ਅਤੇ ਮੈਂ ਉਹ ਵੀ ਮੰਗਾਉਣਾ ਚਾਹੂੰਗਾ ਅਤੇ ਬਾਕੀ ਭਾਅ ਜੀ ਥੈਂਕ ਯੂ ਧੰਨਵਾਦ ਤੁਹਾਡਾ ਜੀ